ਸਾਡੇ ਬ੍ਰਹਿਮੰਡ ਵਿਚਲੇ ਗ੍ਰਹਿਆਂ ਵਿੱਚੋਂ ਵਿਗਿਆਨੀਆਂ ਨੇ ਮੰਗਲ ਗ੍ਰਹਿ ਵਿੱਚ ਜੀਵਨ ਹੋਣ ਬਾਰੇ ਪੁਸ਼ਟੀ ਕੀਤੀ ਹੈ ਐਲਨ ਮਾਸਕ ਇਨਸਾਨਾਂ ਨੂੰ ਮੰਗਲ ਗ੍ਰਹਿ 'ਤੇ ਵਸਾਉਣ ਬਾਰੇ ਟੈਸਲਾ ਅਤੇ ਸਪੇਸ ਦਾ ਦਾਅਵਾ ਹੈ ਕਿ ਉਹ ਅਗਲੇ ਪੰਜਾਹ ਸਾਲ ਲਾ ਤੱਕ ਇਨਸਾਨ ਦਾ ਪੂਰਾ ਸ਼ਹਿਰ ਬਣਾ ਦੇਵੇਗਾ ਜਿਸ ਵਿੱਚ ਦਸ ਲੱਖ ਲੋਕਾਂ ਦਾ ਵਸੇਬਾ ਹੋਏਗਾ ਇਸ ਲਈ ਧਰਤੀ ਦੀ ਕੋਈ ਵੀ ਮਦਦ ਨਹੀਂ ਲਈ ਜਾਵੇਗੀ ਸਗੋਂ ਮੰਗਲ ਗ੍ਰਹਿ ਨੂੰ ਹੀ ਇਸ ਲਈ ਮੁੱਖ ਮੰਨਿਆ ਜਾਵੇਗਾ ਸ਼ੁਰੂ ਤੋਂ ਹੀ ਐਲਨ ਮਾਸਕ ਵਿਦਵਾਨਾਂ ਦਾ ਮਜ਼ਾਕ ਉਡਾਉਣ ਲੱਗੇ ਜਿਸ ਨੂੰ ਸੱਚ ਉਦੋਂ ਮੰਨਿਆ ਜਦੋਂ ਨਾਸਾ ਨੇ ਸਪੇਸਐਕਸ ਦੇ ਇਸ ਦਾਅਵੇ ਨੂੰ ਮੰਨ ਲਿਆ ਹੈ ਪਿਛਲੇ ਕਈ ਸਾਲਾਂ ਤੋਂ ਟਕਨੋਲੋਜੀ ਦੇ ਰਬੋਰਡ ਪੱਖ 'ਤੇ ਕਾਫੀ ਕੰਮ ਕਰ ਲਿਆ ਜਿਵੇਂ ਅ ਅ ਐਲਨ ਮਾਸ ਦੀ ਕੰਪਨੀ ਟੈਸਲਾ ਇਲੈਕਟ੍ਰੀਕਲ ਆਟੋ ਪਾਇਲਟ ਕਾਰਾਂ ਇਸੇ ਤਰ੍ਹਾਂ ਰਾਕਟ ਵਿੱਚ ਅਜਿਹੀਆਂ ਟੈਕਨੋਲੋਜੀ ਵਰਤੋਂ ਕੀਤੀ ਗਈ ਜਿਹੜੀ ਕਿ ਘੱਟ ਤੋਂ ਘੱਟ 'ਤੇ ਖਰਚ 'ਤੇ ਸਪੇਸ ਵਿੱਚ ਪਹੁੰਚ ਸਕਦੀ ਹੈ ਮੰਗਲ ਗ੍ਰਹਿ 'ਤੇ ਜਿਹੜਾ ਕਿ ਧਰਤੀ ਤੋਂ ਛੇ ਕਰੋੜ ਵੀਹ ਲੱਖ ਕਿਲੋਮੀਟਰ ਦੂਰ ਹੈ ਇੱਥੇ ਪਹੁੰਚਣ ਲਈ ਸਟਾਰਫਿਸ਼ ਬਣਾਈ ਜਾ ਰਹੀ ਹੈ ਜੋ ਕਿ ਬੈਟਰੀਆਂ ਵਿੱਚ ਵਰਤੀ ਜਾਣ ਵਾਲੀ ਤਾਰਾਂ ਨਾਲ ਚੱਲੇਗੀ ਇਸ ਤਰ੍ਹਾਂ ਦੂਜੇ ਗ੍ਰਹਿਆਂ 'ਤੇ ਜੀਵਨ ਕਈ ਦਿਲਚਸਪ ਅਤੇ ਅਦਭੁਤ ਸਿਧਾਂਤ ਸਾਹਮਣੇ ਆਏ ਹਨ